ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਸੇ ਸਿਹਤ ਸੰਭਾਲ ਦੀ ਸਮੁੱਚੀ ਸਥਿਤੀ ਹੈ ਇਸ ਤਰ੍ਹਾਂ ਹੈ ਇਲਾਕੇ ਵਿੱਚ ਹਸਪਤਾਲਾਂ ਨੂੰ ਬਹੁਤ ਜ਼ਿਆਦਾ ਬੁਰੀ ਹੈ ਕਿਉਂਕਿ ਸਿਰਫ ਸਿਵਿਲ ਹੋਸਪਿਟਲ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਭਾਲ ਨਹੀਂ ਹੁੰਦੀ ਇਸ ਕਰਕੇ ਹੁਣ ਇਸ ਸਾਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਸਰਕਾਰੀ ਹਸਪਤਾਲਾਂ ਦੇ ਉੱਦਾਂ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਤੇ ਇਸ ਕਰਕੇ ਜ਼ਿਆਦਾ ਸਥਿਤੀ ਬੁਰੀ ਹੋਣ ਕਰਕੇ ਸਾਨੂੰ ਪ੍ਰਾਈਵੇਟ ਹੋਸਪਿਟਲਾਂ ਨਾਲ ਸੰਪਰਕ ਕਰਨਾ ਪੈਂਦਾ ਹੈ ਅਸੀਂ ਆਪਣੇ ਸਾਡੇ ਪਿੰਡ ਦੇ ਕੋਲ ਮਲੋਟ ਸ਼ਹਿਰ ਦੇ ਵਿੱਚ ਸਿਵਲ ਹੋਸਪਿਟਲ ਹੈ ਜਿੱਥੇ ਅਸੀਂ ਸਿਵਲ ਹੋਸਪਿਟਲ 'ਤੇ ਜਾ ਕੇ ਆਪਣਾ ਆਪਣਾ ਇਲਾਜ ਕਰਵਾਉਂਦੇ ਹਾਂ ਅਤੇ ਸਭ ਮਲੋਟ ਹੋਸਪਿਟਲ ਦੇ ਸਿਵਲ ਹੋਸਪਿਟਲ ਨੂੰ ਅਸੀਂ ਬਹੁਤ ਸੌਖਾ ਹੀ ਲੱਭ ਲੈਂਦੇ ਹਾਂ ਜ਼ਿਆਦਾ ਦਿੱਕਤ ਨਹੀਂ ਆਉਂਦੀ ਸਾਨੂੰ ਹੋਸਪਿਟਲ ਲੱਭਣ ਵਿੱਚ ਅਤੇ ਜਿੱਥੋਂ ਤੱਕ ਗੱਲ ਹੈ ਪੰਜਾਬ ਦੇ ਹੋਸਪਿਟਲਾਂ ਦੀ ਸਰਕਾਰੀ ਹੋਸਪਿਟਲਾਂ ਦਾ ਤਾਂ ਬਹੁਤ ਬੁਰਾ ਹਾਲ ਹੈ